ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਮੈਮ ਸਾਡੀਆਂ ਬੱਸਾਂ ਬਹੁਤ ਵਧੀਆ ਨੇ ਤੁਸੀਂ ਜਿੱਥੇ ਵੀ ਜਾਣਾ ਚਾਹੋ ਤੁਸੀਂ ਜਾ ਸਕਦੇ ਜੇ ਸਾਡੀਆਂ ਬੱਸਾਂ ਇੱਥੋਂ ਬਠਿੰਡੇ ਨੂੰ ਅੰਮ੍ਰਿਤਸਰ ਨੂੰ ਕਰਤਾਰਪੁਰ ਜਲੰਧਰ ਬਠਿੰਡਾ ਜਿੱਧਰ ਵੀ ਤੁਸੀਂ ਜਾਣਾ ਹੋਵੇ ਘੁੰਮਣਾ ਹੋਵੇ ਜਾ ਸਕਦੇ ਜੇ ਏ ਸੀ ਬੱਸ ਹੈਗੀ ਆ ਏ ਸੀ ਬੱਸਾਂ ਉਹਦੀਆਂ ਵਧੀਆ ਸੀਟਾਂ ਨੇ ਵਧੀਆ ਬਣੀ ਹੋਈ ਹੈ ਤੁਸੀਂ ਜਿੱਥੇ ਵੀ ਜਾਣਾ ਚਾਹੋ ਜਾ ਸਕਦੇ ਜੇ ਜਿੱਥੇ ਘੁੰਮਣਾ ਹੋਵੇ ਜਿੱਧਰ ਨੂੰ ਵੀ ਮਰਜੀ ਜਾ ਸਕਦੇ ਜੇ ਵਧੀਆ ਸੋਹਣੀਆਂ ਬੱਸਾਂ ਬਣੀਆ ਹੋਈਆ ਨੇ ਸਾਡੀਆਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਬਹੁਤ ਵਧੀਆ ਤੁਸੀਂ ਹਾਂਜੀ ਜੀ ਹਾਂਜੀ ਤੁਸੀਂ ਪਾਣੀ ਵੀ ਪੀਣ ਵਾਸਤੇ ਪੀ ਸਕਦੇ ਜੇ ਵਾਟਰ ਕੂਲਰ ਲੱਗੇ ਹੋਏ ਨੇ ਬਹੁਤ ਵਧੀਆ ਤੁਹਾਨੂੰ ਦੱਸਿਆ ਕਿ ਏ ਸੀ ਬੱਸ ਹੈਗੀ ਆ ਹਰ ਇੱਕ ਸਹੂਲਤ ਮਿਲੂਗੀ ਤੁਹਾਨੂੰ ਜਿਹੜੀ ਤੁਹਾਡੇ ਯੋਗ ਹੋਊਗੀ ਤੁਸੀਂ ਜਿੱਥੇ ਮਰਜੀ ਜਾ ਸਕਦੇ ਜੇ ਹਾਂਜੀ ਜੀ ਹੋਰ ਹਾਂ ਹਾਂਜੀ ਤੁਸੀਂ ਕੋਈ ਗੱਲ ਨਹੀਂ ਜਦੋਂ ਚਾਰ ਵਜੇ ਵੀ ਚੱਲਦੀ ਆ ਤਿੰਨ ਵਜੇ ਵੀ ਚੱਲਦੀ ਆ ਘੰਟੇ ਬਾਅਦ ਬੱਸ ਚੱਲਦੀ ਆ ਤੁਸੀਂ ਜਿੱਥੇ ਵੀ ਜਾਣਾ ਹੋਵੇ ਜਿਹੜੇ ਵੀ ਹਿਸਾਬ ਨਾਲ ਤੁਸੀਂ ਜਿੱਥੇ ਵੀ ਜਾਣਾ ਹੋਵੇ ਤੁਸੀਂ ਦੱਸ ਦਿਓ ਤੁਹਾਨੂੰ ਕੋਈ ਨਹੀਂ ਉਹ ਟਾਈਮ ਦੱਸਦਾਂਗੇ ਵੀ ਇਸ ਟਾਈਮ 'ਤੇ ਸ਼ਹਿਰ ਨੂੰ ਬੱਸ ਚੱਲਦੀ ਆ ਤੁਸੀਂ ਜਾ ਸਕਦੇ ਓਕੇ ਜੀ ਓਕੇ